ਪੇਂਡੂ ਖੇਤਰਾਂ ਦੇ ਵਿੱਚ ਜਿਹੜਾ ਆਪਣਾ ਕਿਸਾਨ ਹੁੰਦੇ ਨੇ ਉਹਨਾਂ ਨੂੰ ਬਹੁਤ ਸਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਵਿੱਤੀ ਸਹਾਇਤਾ ਹੋ ਗਈ ਉਹਨਾਂ ਨੂੰ ਕਿਸਾਨਾਂ ਨੂੰ ਜਿਹੜੇ ਵਿੱਤੀ ਸਹਾਇਤਾ ਆੜ੍ਹਤੀਆਂ ਤੋਂ ਪੈਸੇ ਲੈਣੇ ਪੈਂਦੇ ਨੇ ਗੇ ਜਿਨ੍ਹਾਂ ਕਰਕੇ ਫਿਰ ਉਹਨਾਂ ਦੇ ਸਿਰ ਕਰਜ਼ਾ ਚੜ੍ਹਦਾ ਹੈਗਾ ਉਹਨਾਂ ਨੂੰ ਵਿੱਤੀ ਸਹਾਇਤਾ ਲੈਣੀ ਪੈਂਦੀ ਆ ਕਿਉਂਕਿ ਉਹਨਾਂ ਕੋਲ ਐਨਾ ਪੈਸਾ ਨਹੀਂ ਹੈਗਾ ਵੀ ਹਾਂ ਉਹ ਸਾਰਾ ਕੰਮ ਆਪਣੇ ਆਪ ਕਰ ਲੈਣ ਨਵੀਂ ਨਵੀਂ ਔਜ਼ਾਰ ਆਉਂਦੇ ਨੇ ਗੇ ਮਾਰਕੀਟ ਦੇ ਵਿੱਚ ਉਹ ਉਹਨਾਂ ਨੇ ਖਰੀਦਣੇ ਹੁੰਦੇ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਕੰਮ ਕਰਨਾ ਸੌਖਾ ਹੋ ਜਾਵੇ ਇਸ ਕਰਕੇ ਉਹਨਾਂ ਨੂੰ ਵਿੱਤੀ ਸਹਾਇਤਾ ਦੀ ਲੋੜ ਪੈਂਦੀ ਹੈ ਅਤੇ ਤਾਂ ਜੋ ਉਹ ਆਪਣਾ ਕੰਮ ਕਰ ਸਕਣ ਵਧੀਆ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਆਉਂਦਾ ਆ ਮੌਸਮ ਦੀ ਤਬਦੀਲੀ ਮੌਸਮ ਚੇਂਜ ਹੋ ਜਾਂਦਾ ਆ ਜਿਹੜਾ ਹੁਣ ਹੈ ਨਾ ਦੇਖ ਲਉ ਔਰ ਜਿਹੜੇ ਲੋਕ ਨੇ ਉਹ ਦਰਖਤ ਕੱਟੀ ਜਾਂਦੇ ਨੇ ਗੇ ਉਹਦੇ ਨਾਲ ਕੀ ਆ ਸਾਰਾ ਇਨਵਾਇਰਮੈਂਟ 'ਤੇ ਇਫੈਕਟ ਪੈਂਦਾ ਆ ਜਿਸ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਆਈ ਜਾਂਦੀ ਆ ਜਿਵੇਂ ਹਾਲ ਹੀ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਪਾਣੀ ਆ ਗਿਆ ਸੀ ਬਹੁਤ ਜ਼ਿਆਦਾ ਉਹਦੇ ਨਾਲ ਕਰਕੇ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਿਹੜੇ ਖੇਤ ਨੇ ਗੇ ਉਹ ਸਾਰੇ ਪਾਣੀ ਨਾਲ ਭਰ ਗਏ ਸੀ ਉਹਨਾਂ ਦੀ ਸਾਰੀ ਫਸਲ ਖਰਾਬ ਹੋ ਗਈ ਸੀ ਦਾ ਹੁਣ ਠੰਡ ਦੇ ਵਿੱਚ ਕੀ ਹੁੰਦਾ ਬਰਫ ਗੜੇ ਪੈਣ ਲੱਗ ਜਾਂਦੇ ਨੇ ਗੇ ਪਾਣੀ ਮੀਂਹ ਆ ਜਾਂਦਾ ਹੈਗਾ ਪਾਣੀ ਖੜ੍ਹ ਜਾਂਦਾ ਖੇਤਾਂ ਦੇ ਵਿੱਚ ਉਹਦੇ ਨਾਲ ਕਰਕੇ ਉਹਨਾਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਫਿਰ ਉਸ ਤੋਂ ਬਾਅਦ ਆਉਂਦਾ ਆ ਤਕਨੀਕੀ ਸਹਾਇਤਾ ਜਿਹੜੀਆਂ ਵੀ ਮੁੰ ਅੱਜ ਦੇ ਟਾਈਮ ਦੇ ਵਿੱਚ ਕੀ ਆ ਵੀ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਦੀ ਬਹੁਤ ਲੋੜ ਆ ਜਿਹੜੀਆਂ ਨਵੀਆਂ ਨਵੀਆਂ ਮਸ਼ੀਨਸ ਆਉਂਦੀਆਂ ਨੇ ਮਾਰਕੀਟ ਦੇ ਵਿੱਚ ਉਹਨਾਂ ਬਾਰੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਉਹ ਸਾਰੀਆਂ 'ਚ ਤਕਨੀਕਾਂ ਦੀ ਉਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਤਾਂ ਜੋ ਆਪਣਾ ਕੰਮ ਆ ਜਿਹੜਾ ਵਧੀਆ ਤਰੀਕੇ ਨਾਲ ਕਰ ਸਕਣ ਛੋਟੇ ਪੱਧਰ ਦੇ ਕਿਸਾਨ ਹੁੰਦੇ ਨੇ ਜਿਹੜੇ ਉਹਨਾਂ ਨੂੰ ਸਿਖਲਾਈ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਛੋਟੇ ਪੱਧਰ ਤੋਂ ਵੱਧ ਇਨਕਮ ਕਿਵੇਂ ਪ੍ਰਾਪਤ ਕਰਨੀ ਆ ਆਮਦਨ ਕਿਵੇਂ ਲੈਣੀ ਆ ਅਸੀਂ ਨੇ ਇਸ ਕਰਕੇ ਉਹਨਾਂ ਨੂੰ ਸਾਰੀ ਨੌਲੇਜ ਹੋਣੀ ਚਾਹੀਦੀ ਜੇ ਅਗਰ ਨੋਲੇਜ ਹੀ ਨਹੀਂ ਹੋਊਗੀ ਉਹਨਾਂ ਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਹੋਊਗਾ ਵੀ ਹਾਂ ਅਸੀਂ ਇਹ ਚੀਜ਼ ਨੂੰ ਐਵੇਂ ਕਰਨਾ ਇਸ ਕੰਮ ਨੂੰ ਅਸੀਂ ਇਸ ਤਰੀਕੇ ਨਾਲ ਕਰ ਸਕਦੇ ਹਾਂ ਤਾਂ ਉਹਨਾਂ ਨੂੰ ਨਹੀਂ ਪਤਾ ਲੱਗੇਗਾ ਵੀ ਅਸੀਂ ਕਿਵੇਂ ਇਨਕਮ ਦਾ ਸਾਧਨ ਬਣਾਉਣਾ ਹੈਗਾ ਆਪਣਾ ਇਸ ਕਰਕੇ ਉਹਨਾਂ ਨੂੰ ਇਹ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਮੇਨ ਗੱਲ ਤਾਂ ਇਹੀ ਆਉਂਦੀ ਆ ਵੀ ਹੈ ਨਾ ਕਿਸਾਨਾਂ ਕੋਲ ਐਨਾ ਪੈਸਾ ਨਹੀਂ ਹੁੰਦਾ ਹੈਗਾ ਹੁੰਦਾ ਵੀ ਆ ਮਤਲਬ ਇਹ ਨਹੀਂ ਕਹਿ ਸਕਦੇ ਬਿਲਕੁਲ ਏ ਨਹੀਂ ਹੁੰਦਾ ਹੁੰਦਾ ਆ ਪਰ ਜਿੰਨੇ ਉਹਨਾਂ ਨੂੰ ਖਰਚੇ ਹੁੰਦੇ ਨੇ ਉਸ ਤੋਂ ਘੱਟ ਉਹਨਾਂ ਦੀ ਇਨਕਮ ਹੁੰ ਆਮਦਨ ਹੁੰਦੀ ਆ ਖਰਚੇ ਉਹਨਾਂ ਦੇ ਜ਼ਿਆਦਾ ਹੁੰਦੇ ਨੇ ਕਿਉਂਕਿ ਮੌਸਮ ਦੀ ਤਬਦੀਲੀ ਆਉਂਦੀ ਰਹਿੰਦੀ ਆ ਪਤਾ ਨਹੀਂ ਹੁੰਦਾ ਵੀ ਫਸਲ ਦਾ ਝਾੜ ਇਸ ਵਾਰ ਵਧੀਆ ਆਊਗਾ ਨਹੀਂ ਵਧੀਆ ਆਊਗਾ ਸਾਰਾ ਉਹਦੇ 'ਤੇ ਨਿਰਭਰ ਕਰਦਾ ਆ ਠੀਕ ਆ ਅੰ ਉਹਨਾਂ ਨੂੰ ਆੜ੍ਹਤੀਆਂ ਤੋਂ ਪੈਸੇ ਲੈਣੇ ਪੈਂਦੇ ਨੇ ਫਿਰ ਆੜ੍ਹਤੀਆਂ ਤੋਂ ਪੈਸੇ ਲੈਂਦੇ ਨੇ ਗੇ ਉਹ ਫਿਰ ਕਰਜ਼ੇ ਦੇ ਵਿੱਚ ਡੁੱਬ ਜਾਂਦੇ ਨੇ